ਪਸ਼ੂਆਂ ਨੂੰ ਬਿਮਾਰੀ ਤੋਂ ਬਚਾਉਣ ਲਈ ਬਹੁਤ ਸਾਰੇ ਇਲਾਜ ਹਨ ਪੁਰਾਤਨ ਸਮੇਂ ਵਿੱਚ ਪਸ਼ੂਆਂ ਨੂੰ ਬਿਮਾਰੀ ਨਾਲ ਬਚਾਉਣ ਬਿਮਾਰੀ ਤੋਂ ਬਚਾਉਣ ਲਈ ਕਈ ਦੇਵਤਿਆਂ ਨੂੰ ਪੂਜੀ ਪੂਜਿਆ ਜਾਂਦਾ ਸੀ ਜਿਵੇਂ ਕਿ ਗਊ ਮਾਤਾ ਨੂੰ ਮਾਂ ਦੇ ਸਮਾਨ ਮੰਨਿਆ ਜਾਂਦਾ ਸੀ ਉਹਨਾਂ ਨੂੰ ਪੂਜਿਆ ਜਾਂਦਾ ਸੀਗਾ ਕਈ ਦੇਵਤਿਆਂ ਨੂੰ ਪੂਜਣ ਨਾਲ ਪਸ਼ੂਆਂ ਦੇ ਇਲਾਜ ਕੀਤਾ ਜਾਂਦਾ ਸੀਗਾ ਪਰ ਅੱਜ ਕੱਲ ਦੇ ਜਮਾਨੇ ਵਿੱਚ ਉਹਨਾਂ ਨੂੰ ਸਹੀ ਰਹਿਣ ਸਹਿਣ ਨਾਲ ਰੱਖਿਆ ਜਾਂਦਾ ਹੈ ਉਹਨਾਂ ਦਾ ਉਹਨਾਂ ਦੇ ਦੇਖਭਾਲ ਕੀਤੀ ਜਾਂਦੀ ਹੈ ਜਿਨਾਂ ਕਰਕੇ ਪਸ਼ੂ ਬਿਮਾਰ ਘੱਟ ਹੁੰਦੇ ਹਨ ਅਤੇ ਉਹਨਾਂ ਦਾ ਇਲਾਜ ਵੀ ਸਹੀ ਤਰੀਕੇ ਨਾਲ ਕਰਾਇਆ ਜਾਂਦਾ ਹੈ ਪੁਰਾਤਨ ਸਮਿਆਂ ਵਿੱਚ ਪਸ਼ੂਆਂ ਨੂੰ ਠੀਕ ਰੱਖਣ ਲਈ ਪੂਜਿਆਂ ਜਾਂਦਾ ਸੀ ਕਈ ਦੇਵਤਿਆਂ ਨੂੰ ਮੰਨਿਆ ਜਾਂਦਾ ਸੀਗਾ ਪਰੰਤੂ ਅੱਜ ਕੱਲ ਦੇ ਜਮਾਨੇ ਵਿੱਚ ਪਸ਼ੂਆਂ ਨੂੰ ਸਹੀ ਤਰੀਕੇ ਨਾਲ ਰੱਖਿਆ ਜਾਂਦਾ ਹੈ ਜਿਨਾਂ ਕਰਕੇ ਉਹ ਬਿਮਾਰੀ ਤੋਂ ਬਚੇ ਰਹਿੰਦੇ ਹਨ ਉਹਨਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਪਸ਼ੂਆਂ ਦੀ ਦੇਖਭਾਲ ਸਹੀ ਤਰੀਕੇ ਨਾਲ ਰੱਖੀ ਗਈ ਜਾਂਦੀ ਪਸ਼ੂਆਂ ਨੂੰ ਸਹੀ ਤਰੀਕੇ ਨਾਲ ਰੱਖਿਆ ਜਾਂਦਾ ਹੈ ਅਤੇ ਕਿਸੇ ਵੀ ਦੇਵਤੇ ਦੇਵਤਿਆਂ ਨੂੰ ਮੰਨਣ ਦੀ ਜਰੂਰਤ ਨਹੀਂ ਪੈਂਦੀ ਗਊ ਮਾਤਾ ਨੂੰ ਵੀ ਮਾਂ ਸਮਾਨ ਮੰਨਿਆ ਜਾਂਦਾ ਸੀ ਪੁਰਾਣੇ ਸਮੇਂ ਵਿੱਚ ਪਰੰਤੂ ਇਸ ਹੁਣ ਦੇ ਜਮਾਨੇ ਵਿੱਚ ਇਦਾਂ ਦਾ ਕੁਝ ਨਹੀਂ ਹੁੰਦਾ ਉਹਨਾਂ ਨੂੰ ਸਹੀ ਤਰੀਕੇ ਨਾਲ ਰੱਖਿਆ ਜਾਂਦਾ ਹੈ ਅਤੇ ਉਹਨਾਂ ਨੂੰ ਬਿਮਾਰੀ ਤੋਂ ਬਚਾਇਆ ਜਾਂਦਾ ਹੈ ਇਦਾਂ ਤਾਂ ਨਹੀਂ ਹੁੰਦਾ ਕਿ ਕਿਸੇ ਦੇਵਤਿਆਂ ਨੂੰ ਪੂਜਣ ਨਾਲ ਪਸ਼ੂਆਂ ਦੀ ਸਿਹਤ ਠੀਕ ਰਹੇ ਉਹਨਾਂ ਨੂੰ ਖਾਣਾ ਸਹੀ ਤਰੀਕੇ ਨਾਲ ਦੇਣਾ ਚਾਹੀਦਾ ਹੈ ਉਹਨਾਂ ਦਾ ਰਹਿਣ ਸਹਿਣ ਸਹੀ ਤਰੀਕੇ ਨਾਲ ਰੱਖਿਆ ਜਾਂਦਾ ਹੈ ਜਿਨਾਂ ਨਾਲ ਪਸ਼ੂ ਠੀਕ ਰਹਿੰਦੇ ਹਨ